ਭਾਰਤ ਦੇ ਵਿੱਚ ਜਦੋਂ ਵੀ ਕੋਈ ਤਿਉਹਾਰ ਜਾਂ ਫਿਰ ਕੋਈ ਧਾਰਮਿਕ ਮੌਕਾ ਹੁੰਦਾ ਹੈ ਤਾਂ ਦੇਵੀ ਦੇਵਤਿਆਂ ਦੀ ਜਿਹੜੀ ਪੂਜਾ ਹੈਗੀ ਲਾਜ਼ਮੀ ਹੀ ਕਰਦੇ ਹਨ ਕਿਉਂਕਿ ਦੇਵੀ ਦੇਵਤਿਆਂ ਦੀ ਪੂਜਾ ਤੋਂ ਬਿਨਾਂ ਤਾਂ ਕੋਈ ਵੀ ਕੰਮ ਜਾਂ ਕੋਈ ਵੀ ਜਿਹੜਾ ਤਿਉਹਾਰ ਦਾ ਮੌਕਾ ਹੈਗਾ ਸ਼ੁਰੂ ਨਹੀਂ ਕਰਦੇ ਜਦੋਂ ਵੀ ਕੋਈ ਜਿਵੇਂ ਕਿ ਹੁਣ ਵਰਤ ਰੱਖਦੇ ਹੈਗੇ ਝੱਖਰੀ ਦਾ ਝੱਖਰੀ ਦਾ ਵਰਤ ਰੱਖਣ ਕਰਕੇ ਵੀ ਇੱਕ ਜਿਹੜੀ ਹੋਈ ਮਾਤਾ ਹੈਗੀ ਉਹਦੀ ਪੂਜਾ ਕਰਦੇ ਹਨ ਹੋਈ ਮਾਤਾ ਦੀ ਜਿਹਨਾਂ ਦੇ ਕੋਲ ਫੋਟੋ ਨਹੀਂ ਹੁੰਦੀ ਉਹ ਕੰਧ ਦੇ ਉੱਤੇ ਹੋਈ ਮਾਤਾ ਦੀ ਫੋਟੋ ਬਣਾ ਲੈਂਦੇ ਹਨ ਹੋਈ ਮਾਤਾ ਦੀ ਫੋਟੋ ਬਣਾ ਕੇ ਕੋਲ ਉਹਦੇ ਗੰਨੇ ਰੱਖ ਕੇ ਕੁੱਜੀ ਰੱਖ ਕੇ ਝੱਖਰੀ ਵਾਲੇ ਜਿਹੜੇ ਹੁੰਦੇ ਹੈਗੇ ਉਹ ਰੱਖ ਕੇ ਕੋਲ ਉਹਦੇ ਵੀ ਫਲ ਫਰੂਟ ਰੱਖ ਦਿੰਦੇ ਹੈਗੇ ਵੀ ਸਾਰਾ ਕੁਝ ਰੱਖ ਕੇ ਜਦੋਂ ਕਹਾਣੀ ਸੁਣ ਲੈਂਦੇ ਕਹਾਣੀ ਸੁਣਨ ਤੋਂ ਬਾਅਦ ਫਿਰ ਉਸਨੂੰ ਅਰਗ ਦੇ ਕੇ ਅਰਗ ਦੇ ਦਿੰਦੀ ਹੈ ਅਰਗ ਦੇਣ ਤੋਂ ਬਾਅਦ ਫਿਰ ਉਸ ਨੂੰ ਤਹਾ ਉਤਾਰ ਕੇ ਪਾਣੀ ਪੀ ਲੈਂਦੀ ਅਰਗ ਦੇਣ ਤੋਂ ਬਾਅਦ ਪਾਣੀ ਪੀ ਲੈਂਦੇ ਹਨ ਇਸ ਤਰ੍ਹਾਂ ਜਿਹੜੀ ਹੋਈ ਮਾਤਾ ਦੀ ਪੂਜਾ ਕਰਦੇ ਹਨ ਅਤੇ ਜਾਂ ਫਿਰ ਦੀਵਾਲੀ ਮੌਕੇ ਲੱਛਮੀ ਮਾਤਾ ਦੀ ਪੂਜਾ ਕਰਦੇ ਹਨ ਕਿਉਂਕਿ ਲੱਛਮੀ ਮਾਤਾ ਦੀ ਪੂਜਾ ਇਸ ਕਰਕੇ ਕਰਦੇ ਹਨ ਕਿਉਂਕਿ ਲੋਕਾਂ ਨੂੰ ਇਹ ਚੀਜ਼ ਦਾ ਹੁੰਦਾ ਹੈ ਕਿ ਲੱਛਮੀ ਮਾਤਾ ਘਰ ਆਉਣ ਜਿਵੇਂ ਸਫਾਈ ਕਰਦੇ ਆ ਸਫਾਈ ਕਰਕੇ ਮਾਤਾ ਜੀ ਨੂੰ ਵਧੀਆ ਵੀ ਸਾਫ ਥਾਂ 'ਤੇ ਬਠਾਉਂਦੇ ਹਨ ਵੀ ਜਿਸ ਕਰਕੇ ਉਹਨਾਂ ਨੂੰ ਇਹ ਚੀਜ਼ ਹੁੰਦੀ ਹੈ ਕਿ ਸਾਡੇ ਘਰ ਲੱਛਮੀ ਆਵੇਗੀ ਲੱਛਮੀ ਮਾਤਾ ਦੀ ਪੂਜਾ ਇਸ ਕਰਕੇ ਕਰਦੇ ਹਨ ਉਹ ਦੀਵਾਲੀ ਮੌਕੇ ਹੀ ਕਰਦੇ ਹਨ ਥੈਂਕ ਯੂ